ਹਾਂਜੀ ਅਸੀਂ ਵਹਿਮਾਂ ਭਰਮਾਂ ਬਾਰੇ ਸਾਡੇ ਇਲਾਕੇ ਵਿੱਚ ਤੇ ਅਸੀਂ ਵਿਸ਼ਵਾਸ ਕਰਦੇ ਵੀ ਹਾਂ ਤੇ ਵਿਸ਼ਵਾਸ ਅੱਜ ਕੱਲ ਤੇ ਪਤਾ ਇਦਾਂ ਕਿਤੇ ਜਾਣ ਲੱਗਿਆਂ ਵੀ ਜਿੱਦਾਂ ਵੀ ਬਿੱਲੀ ਰਸਤਾ ਕੱਟ ਗਈ ਤੇ ਅਸੀਂ ਕਹਿੰਦੇ ਆ ਅਸੀਂ ਅੱਗੇ ਨਹੀਂ ਜਾਣਾ ਜੀ ਦਿੱਲੀ ਸਾਡਾ ਰਸਤਾ ਕੱਟ ਗਈ ਆ ਤਾਂ ਸਾਡਾ ਕੰਮ ਨਹੀਂ ਹੋਏਗਾ ਪਰ ਸਾਡੇ ਹਿਸਾਬ ਨਾਲ ਲੋਕੀ ਕਈ ਅਸੀਂ ਵਿਸ਼ਵਾਸ ਕਰ ਵੀ ਲੈਦੇ ਆ ਤੇ ਅਤੇ ਨਹੀਂ ਵੀ ਕਰਦੇ ਹਾਂ ਕਿਉਂਕਿ ਕਈ ਵਾਰੀ ਸਾਡੇ ਗੁਰੂ ਵਗੈਰਾ ਕਹਿੰਦੇ ਆ ਕਿ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਣਾ ਪਰ ਦੇਖੋ ਸਾਡੇ ਇਲਾਕੇ ਵਿੱਚ ਵੀ ਤੇ ਆਮ ਦੇਖਿਆ ਹੈ ਕਿ ਲੋਕੀ ਇਨਾ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ ਕਿਉਂਕਿ ਅਸੀਂ ਕੋਈ ਸਾਡੇ ਘਰ ਦੇ ਅੱਗੇ ਕੋਈ ਚੀਜ਼ ਸੁੱਟ ਕੇ ਚਲਾ ਜਾਂਦਾ ਹੈ ਤੇ ਅਸੀਂ ਕਹਿੰਦੇ ਨਹੀਂ ਨਹੀਂ ਅਸੀਂ ਪਹਿਲਾਂ ਇਹਦੇ ਉੱਤੇ ਕੁਛ ਪਾਣੀ ਪੂਣੀ ਖਾਂਦੇ ਆ ਤੇ ਫਿਰ ਅਸੀਂ ਕਹਿੰਦੇ ਆ ਨਹੀਂ ਭਗਵਾਨ ਦਾ ਨਾਮ ਪਤਾ ਨਹੀਂ ਕੀ ਹੋ ਗਿਆ ਇਸ ਕਰਕੇ ਅੱਜ ਕੱਲ ਅਸੀਂ ਦੇਖਿਆ ਹੀ ਗਿਆ ਹੈ ਕਿ ਲੋਕੀ ਵਿਸ਼ਵਾਸ ਕਰਦੇ ਹੀ ਹਨ ਤੇ ਕਹਿ ਦਿੰਦੇ ਹੈ ਕਿ ਨਹੀਂ ਵੀ ਕਰਦੇ ਤੇ ਅੱਜ ਕੱਲ ਤੁਸੀਂ ਦੇਖੋ ਜੀ ਫੋਨਾਂ ਤੇ ਵੀ ਬੜਾ ਇਹਨਾਂ ਦਾ ਪ੍ਰਚਾਰ ਹੋ ਰਿਹਾ ਹੈ ਜਿੱਦਾਂ ਇੰਟਰਨੈਟ ਤੇ ਕੋਈ ਨਾ ਕੋਈ ਪੰਡਤ ਇਸਟੋਲੇਜ ਦੱਸਦੇ ਤੁਸੀਂ ਸੋਮਵਾਰ ਐ ਕਰੋ ਮੰਗਲਵਾਰ ਉਹ ਕਰੋ ਬੁੱਧਵਾਰ ਉਹ ਕਰੋ ਬਾਕੀ ਭਗਵਾਨ ਦਾ ਨਾਮ ਲੈਣਾ ਇੱਕ ਅਲੱਗ ਗੱਲ ਹੈ ਤੇ ਤੇ ਉਹ ਵਹਿਮਾਂ ਭਰਮਾ ਤੇ ਵਿਸ਼ਵਾਸ ਕਰਨਾ ਇੱਕ ਅਲੱਗ ਗੱਲ ਹੈ ਬਾਕੀ ਜੇ ਤੁਸੀਂ ਵਹਿਮਾਂ ਭਰਮਾ ਦੇ ਨਾਲ ਚੱਲੋ ਬਾਕੀ ਤੁਸੀਂ ਉਹਨਾਂ ਦੇ ਉੱਤੇ ਪੂਰੇ ਨਿਰਭਰ ਨਾ ਹੋ ਕੁਛ ਹੀ ਗੱਲਾਂ ਤੇ ਤੁਸੀਂ ਉਹਨਾਂ ਦੇ ਜਾਓ ਪਰ ਪੂਰਾ ਵੀ ਆਪਣਾ ਜੀਵਨ ਵੀ ਵਹਿਮਾਂ ਭਰਮਾਂ ਦੇ ਨਾਲ ਨਾ ਵਿਤਾਓ ਬਸ ਉੱਦਾਂ ਚਲੋ ਠੀਕ ਹੈ ਵੀ ਤੁਸੀਂ ਭਗਵਾਨ ਤੇ ਜਾਓ ਮੰਗਲਵਾਰ ਨੂੰ ਹਨੂਮਾਨ ਜੀ ਦੇ ਤੇ ਜਾਓ ਪਾਠ ਕਰੋ ਜਾਂ ਜੋ ਵੀ ਕਰੋ ਬਸ ਇਸ ਤੋਂ ਇਲਾਵਾ ਬਸ ਜੀ ਧੰਨਵਾਦ